ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣ ਵਾਲੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਬਹੁਤ ਹੋ ਰਿਹਾ ਇਸ ਲਈ ਉਹ ਗਲਤ ਹੈ ਕਿਉਂਕਿ ਜੇ ਨੌਜਵਾਨ ਉੱਧਰ ਨਾ ਜਾਣ ਇਹਦੇ ਨਾਲ ਪੰਜਾਬ 'ਤੇ ਬਹੁਤ ਜ਼ਿਆਦਾ ਅਸਰ ਹੋਇਆ ਹੈ ਪੰਜਾਬ 'ਤੇ ਇਸ ਕਰਕੇ ਅਸਰ ਹੋਇਆ ਹੋਇਆ ਕਿਉਂਕਿ ਨੌਜਵਾਨ ਉੱਧਰ ਜਾ ਰਹੇ ਨੇ ਅਤੇ ਪੰਜਾਬ ਦਾ ਕੰਮ ਖਤਮ ਹੋ ਰਿਹਾ ਹੈ ਪੰਜਾਬ ਵਿੱਚ ਉਹ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰ ਸਕਦੇ ਹਨ ਜੇ ਉਹ ਚਾਹੁੰਣ ਤਾਂ ਜਿਹੜਾ ਜੋ ਕੰਮ ਵਿਦੇਸ਼ਾਂ ਵਿੱਚ ਕਰ ਰਹੇ ਨੇ ਉਹ ਪੰਜਾਬ ਵਿੱਚ ਵੀ ਕਰ ਸਕਦੇ ਨੇ ਇਸ ਲਈ ਪੰਜਾਬ ਨੂੰ ਤਾਂ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ ਕਿਉਂਕਿ ਪੰਜਾਬ ਦਾ ਪੰਜਾਬ ਦੇ ਨੌਜਵਾਨ ਉੱਧਰ ਜਾ ਰਹੇ ਨੇ ਇਸ ਕਰਕੇ ਪੰਜਾਬ 'ਤੇ ਬਹੁਤ ਸ ਮਾੜਾ ਅਸਰ ਹੋ ਰਿਹਾ ਹੈ ਅਤੇ ਜਵਾਨੀ ਤਾਂ ਸਾਰੀ ਪੰਜਾਬ ਦੀ ਬਾਹਰ ਜਾ ਰਹੀ ਹੈ ਅਤੇ ਇਸ ਲਈ ਪੰਜਾਬ 'ਤੇ ਅਸਰ ਬਹੁਤ ਜ਼ਿਆਦਾ ਪੈ ਰਿਹਾ ਹੈ ਅਤੇ ਪੰਜ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਧਰ ਰਹਿ ਕੇ ਕੰਮ ਕਰਨ ਪੰਜਾਬ ਦੇ ਵਿੱਚ ਵੀ ਉਹ ਕੰਮ ਕਰ ਸਕਦੇ ਨੇ ਜੋ ਉਹ ਹੁਣ ਬਾਹਰ ਜਾ ਕੇ ਕੰਮ ਕਰਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਜੋ ਕੰਮ ਕਰਦੇ ਨੇ ਉਹ ਇੱਧਰ ਵੀ ਕਰ ਸਕਦੇ ਨੇ ਅਤੇ ਇੱਧਰ ਇਸ ਕਰਕੇ ਪੰਜਾਬ ਦੇ ਨੌਜਵਾਨਾਂ 'ਤੇ ਪੰਜਾਬ ਦੇ ਉੱਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਧਰ ਰਹਿ ਕੇ ਉਹ ਕੰਮ ਕਰ ਸਕਦੇ ਹਨ ਜੋ ਉਹ ਉੱਧਰ ਜਾ ਕੇ ਕਰਦੇ ਨੇ ਕੀਮਤ ਤਾਂ ਇੱਧਰ ਵੀ ਬਹੁਤ ਜ਼ਿਆਦਾ ਮਿਲ ਸਕਦੀ ਹੈ ਉਹਨਾਂ ਨੂੰ ਉਸ ਕੰਮ ਦੀ ਵਿਦੇਸ਼ਾਂ ਦੇ ਵਿੱਚ ਇਸ ਕਰਕੇ ਵਿਦੇਸ਼ ਤਾਂ ਜਾਣ ਵਾਸਤੇ ਪੰਜਾਬ 'ਤੇ ਮਾੜਾ ਅਸਰ ਹੋ ਰਿਹਾ ਹੈ